ਇੱਕ ਹਜ਼ਾਰ ਦੋ ਸੌ ਚੌਂਤੀ ਪੰਜ ਹਜ਼ਾਰ ਛੇ ਸੌ ਸਤਾਨਵੇਂ ਦਸ ਹਜ਼ਾਰ ਤਿੰਨ ਸੌ ਬਾਰਾਂ ਇਕ ਲੱਖ ਪੰਜ ਸੌ ਅਠਾਰਾਂ ਅਤੇ ਪੈਂਤੀ ਸੌ ਛਿਆਲੀ